ਹਾਂ ਮੈਂ ਚੈਸ ਦੇ ਔਨਲਾਈਨ ਟੂਰਨਾਮੈਂਟ ਵਿੱਚ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਇਹ ਚੈਸ ਡੋਟ ਕੋਮ ਜੋ ਕਿ ਚੈਸ ਦੇ ਇੱਕ ਅੱਵਲ ਅਤੇ ਪ੍ਰਮੁੱਖ ਵੈੱਬਸਾਈਟ ਹੈ ਉਸ ਉਪਰ ਆਯੋਜਿਤ ਕੀਤਾ ਗਿਆ ਸੀਗਾ ਮੁਕਾਬਲਾ ਬਹੁਤ ਚੰਗੇ ਢੰਗ ਨਾਲ ਆਯੋਜਿਤ ਕੀਤਾ ਗਿਆ ਸੀ ਇਸ ਵਿੱਚ ਵੱਖਰੇ ਵੱਖਰੇ ਰੂਮ ਬਣਾਏ ਹੋਏ ਸਨ ਜਿਸ ਵਿੱਚ ਕੋਈ ਵੀ ਓਡੀਅੰਸ ਚੈਸ ਦਾ ਮੈਚ ਦੇਖ ਸਕਦੀ ਸੀ ਕੋਈ ਸ਼ਿਕਾਇਤ ਦਰਜ ਕਰਾਉਣ ਲਈ ਆਰਬੀਟਰੇਟਰ ਵੀ ਸਨ ਮੈਨੂੰ ਹਿੱਸਾ ਲੈ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਟੂਰਨਾਮੈਂਟ ਸੀ ਜਿਸ ਵਿੱਚ ਲਗਭਗ ਇੱਕ ਹਜ਼ਾਰ ਤੋਂ ਵੀ ਵੱਧ ਖਿਡਾਰੀ ਹਿੱਸਾ ਲੈ ਰਹੇ ਸਨ ਖੇਡ ਦਾ ਪੁਆਇੰਟ ਟੇਬਲ ਵੀ ਹਰ ਗੇਮ ਤੋਂ ਬਾਅਦ ਆਪਣੇ ਆਪ ਆਟੋਮੈਟਿਕ ਅਪਡੇਟ ਹੋ ਜਾਂਦਾ ਸੀ ਅਤੇ ਸਭ ਨੂੰ ਹਰ ਰਾਊਂਡ ਤੋਂ ਬਾਅਦ ਇਸ ਬਾਬਤ ਈਮੇਲ ਵੀ ਪਹੁੰਚ ਜਾਂਦਾ ਸੀ ਇੱਥੇ ਅਭਿਆਸ ਕਰਨ ਲਈ ਪ੍ਰੈਕਟਿਸ ਕਰਨ ਲਈ ਕੰਪਿਊਟਰ ਨਾਲ ਵੀ ਖੇਡਿਆ ਜਾ ਸਕਦਾ ਸੀ ਮੈਂ ਦੋ ਰਾਊਂਡ ਪਾਰ ਕੀਤੇ ਸਨ ਅਤੇ ਉਸ ਤੋਂ ਬਾਅਦ ਮੈਂ ਅੱਗੇ ਨਹੀਂ ਖੇਡ ਸਕਿਆ ਸੀ ਮੈਨੂੰ ਬਹੁਤ ਹੀ ਚੰਗਾ ਲੱਗਾ ਅਤੇ ਮੇਰਾ ਐਕਸਪੀਰੀਅੰਸ ਬਹੁਤ ਹੀ ਵਧੀਆ ਰਿਹਾ